ਜਿਵੇਂ ਕਿ ਆਪਾਂ ਘਰ ਦਾ ਕੂੜਾ ਘ ਘਰ ਦੀ ਸਾਫ ਸਫਾਈ ਕਰਦੇ ਹਾਂ ਅਤੇ ਘਰ ਦਾ ਕੂੜਾ ਆਪਣੇ ਡਸਬਿਨ 'ਚ ਪਾਉਂਦੇ ਹਾਂ ਤਾਂ ਗਿੱਲਾ ਕੂੜਾ ਅਲੱਗ ਰੱਖਦੇ ਹਾਂ ਅਤੇ ਸੁੱਕਾ ਆਪਾਂ ਅਲੱਗ ਰੱਖਦੇ ਹਾਂ ਅਤੇ ਜੋ ਸੁੱਕਾ ਕੂੜਾ ਉਹ ਆਪਾਂ ਸਾੜ ਦਿੰਦੇ ਹਾਂ ਅਤੇ ਜਿਹੜਾ ਗਿੱਲਾ ਕੂੜਾ ਚਾਹੇ ਉਹ ਆਪਾਂ ਬਾਹਰ ਕਿਤੇ ਇਕੱਠਾ ਕਰਕੇ ਅਤੇ ਉਹਦਾ ਖਾਦ ਬਣਾ ਸਕਦੇ ਹਾਂ ਅਤੇ ਚਾਹੇ ਉਹ ਆਪਾਂ ਘਰੇ ਵੀ ਕੋਲ ਟੋਆ ਪਟ ਕੇ ਕਰ ਸਕਦੇ ਇਹੀ ਜਿਹੜਾ ਕੰਮ ਹੈ ਆਪਾਂ ਰੋਜ਼ ਬਾਹਰ ਵੀ ਕਰ ਸਕਦੇ ਹਾਂ ਘਰ ਅਤੇ ਸਾਜ ਦੀ ਸਫਾ ਸਾਫ ਸਫਾਈ ਦੇ ਨਾਲ ਬਾਹਰ ਵੀ ਆਪਾਂ ਆਲਾ ਦੁਆਲਾ ਵੀ ਸਾਫ ਰੱਖ ਸਕਦੇ ਹਾਂ ਕਿਉਂਕਿ ਜਿਹੜਾ ਬਾਹਰ ਕੂੜਾ ਸੁੱਟਦੇ ਆਪਾਂ ਉਹਨੂੰ ਵੀ ਆਪਾਂ ਚੰਗੇ ਤਰੀਕੇ ਨਾਲ ਮਤਲਬ ਵੀ ਉਹਨੂੰ ਸਾੜ ਸਕਦੇ ਹਾਂ ਸੁੱਕੇ ਕੂੜੇ ਨੂੰ ਅਤੇ ਆਂਡ ਗਵਾਂਡ ਜੋ ਵੀ ਆਪਣੀ ਗਲੀ ਵਿੱਚ ਜਿੰਨੇ ਵੀ ਘਰ ਹੈਗੇ ਆ ਉਹਨਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਭਾਈ ਆਪਾਂ ਇਕੱਠਾ ਕਰਕੇ ਕੂੜਾ ਜਿਹੜਾ ਉਹ ਆਪਾਂ ਗਿੱਲਾ ਕੂੜਾ ਜਿਹੜਾ ਸਾਰਾ ਇਕੱਠਾ ਕਰਕੇ ਉਹਨੂੰ ਆਪਾਂ ਇੱਕ ਥਾਂ 'ਤੇ ਇਕੱਠਾ ਕਰੀਏ ਅਤੇ ਉਹਨੂੰ ਸਾਫ ਸਫਾਈ ਦੇ ਮਤਲਬ ਵੀ ਇਹਨੂੰ ਖਾਦ ਬਣਾਈਏ ਅਤੇ ਖਾਦ ਜਿਹੜੀ ਹੈ ਵੀ ਉਹ ਆਪਣੀ ਘਰ ਦੇ ਬੂਟਿਆਂ ਵਿੱਚ ਵੀ ਜੋ ਵੀ ਜਿਹਨੂੰ ਵੀ ਲੋੜ ਹੋਵੇ ਉਹ ਆਪਦੀ ਖਾਦ ਲ ਲੈ ਸਕਦਾ ਆਪਦੇ ਬੂਟਿਆਂ ਨੂੰ ਪਾਓ ਬੂਟੇ ਵਧਣ ਫੁੱਲਣਗੇ ਘਰ ਵੀ ਸਾਫ ਸੁਥਰਾ ਰੱਖਾਂਗੇ ਅਤੇ ਜਿਵੇਂ ਆਪਾਂ ਘਰ ਸਾਫ ਸੁਥਰਾ ਰੱਖਦੇ ਹਾਂ ਉਹ ਬਾ ਉਹਨੂੰ ਵੀ ਬਾਹਰ ਵੀ ਆਪਾਂ ਸਾਫ ਸੁਥਰਾ ਰੱਖ ਸਕਦੇ ਹਾਂ ਨਾਲੇ ਤਾਂ ਬਿਮਾਰੀਆਂ ਦਾ ਘੱਟ ਖਦਸਾ ਹੁੰਦਾ ਅਤੇ ਨਾਲੇ ਕੋਈ ਮੱਛਰ ਵਗੈਰਾ ਨਹੀਂ ਆਉਂਦਾ ਹੈਗਾ ਜੇ ਆਪਾਂ ਸਾਫ ਸੁਥਰਾ ਰੱਖਾਂਗੇ ਤਾਂ ਅਤੇ ਇਹੀ ਹੈ ਵੀ ਅਸੀਂ ਘਰ ਨੂੰ ਵੀ ਸਾਫ ਰੱਖੋ ਅਤੇ ਆਪਦਾ ਗਲੀ ਗਵਾਂਡ ਸਾਰਾ ਕੁਛ ਸਾਫ ਰੱਖੋ